ਸਕੂਲਾਂ ਵਿੱਚ ਬਚਪਨ ਤੋਂ ਸਾਨੂੰ ਸਭ ਤੋਂ ਪਹਿਲੇ ਅੰਗਰੇਜ਼ੀ 'ਚ ਏ ਬੀ ਸੀ ਡੀ ਪੜ੍ਹਾਈ ਜਾਂਦੀ ਹੈ ਕਿ ਸਾਨੂੰ ਉਹਦੇ ਅੱਖਰ ਲਿਖਣੇ ਪੜ੍ਹਾਏ ਜਾਂਦੇ ਹੈ ਮੈਂਸਥਾਮੈਟਿਕਸ 'ਚ ਸਾਨੂੰ ਪਹਿਲੇ ਵਰਡਸ ਅਲਫਾਬੈਟਸ ਪੜ੍ਹਾਏ ਜਾਂਦੇ ਹੈ ਵਨ ਟੂ ਥ੍ਰੀ ਵਨ ਟੂ ਹੰਡਰਡ ਪਹਿਲੇ ਸਾਨੂੰ ਬੇਸਿਕਸ ਨਾਲ ਸਟਾਰਟ ਕਰਵਾਇਆ ਜਾਂਦਾ ਸੋ ਸਾਨੂੰ ਲਿਖਣਾ ਪੜ੍ਹਨਾ ਬੋਲਣਾ ਸਮਝਣਾ ਆ ਜਾਏ ਸਕੂਲਾਂ 'ਚ ਸਭ ਤੋਂ ਪਹਿਲੇ ਇਹੀ ਪੜ੍ਹਾਇਆ ਜਾਂਦਾ ਸਾਨੂੰ ਅਤੇ ਅਧਿਆਪਕ ਸਾਡੇ ਚੰਗੇ ਵੀ ਹੋ ਸਕਦੇ ਹੈ ਕਈ ਵਾਰੀ ਬਹੁਤ ਹੀ ਘੱਟ ਚਾਂਸ ਹੈ ਕਿ ਕੋਈ ਇੱਕ ਅੱਧਾ ਅਧਿਆਪਕ ਨਾ ਵੀ ਚੰਗਾ ਹੋਏ ਜ਼ਿਆਦਾਤਰ ਅਧਿਆਪਕ ਚੰਗੇ ਹੀ ਹੁੰਦੇ ਨੇ ਉਹ ਜੇ ਤੁਹਾਡੇ ਅਧਿਆਪਕ ਨੇ ਅਤੇ ਉਹ ਕਿਸੇ ਕਾਰਨ ਵਰਸ਼ ਹੀ ਸਾਡੇ ਅਧਿਆਪਕ ਨੇ ਉਹ ਵੀ ਪੜ੍ਹ ਲਿਖ ਕੇ ਹੀ ਉੱਥੇ ਬੈ ਅਧਿਆਪਕ ਬਣੇ ਆ ਸਾਡੇ ਉਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਦਾਰੀ ਇਹੀ ਹੈ ਕਿ ਉਹ ਸਾਨੂੰ ਪੜ੍ਹਾਉਂਦੇ ਹੈ ਬੇਸਿਕਸ ਤੋਂ ਅਤੇ ਬਹੁਤ ਅੱਛਾ ਅਤੇ ਸਕੂਲਾਂ ਵਿੱਚ ਪਹਿਲੇ ਸਾਨੂੰ ਬੇਸਿਕਸ 'ਚੋਂ ਇੰਗਲਿਸ਼ ਹੁੰਦੀ ਹੈ ਮੈਥਾਮੈਟਿਕਸ ਹੁੰਦੀ ਹੈ ਅਤੇ ਜਿੱਦਾਂ ਜਿੱਦਾਂ ਆਪਾਂ ਵੱਡੇ ਹੋਈ ਜਾਂਦੇ ਹੈ ਸਾਨੂੰ ਸਬਜੈਕਟਸ ਵੀ ਵਧੀ ਜਾਂਦੇ ਹੈ ਸਾਡੇ ਅਤੇ ਵਿਸ਼ੇ ਵਧੇ ਜਾਂਦੇ ਹੈ ਇੰਗਲਿਸ਼ ਮੈਥਾਮੈਟਿਕਸ ਅਤੇ ਸਾਇੰਸ ਅਤੇ ਹੋਰ ਹਿਸਟਰੀ ਦੇ ਬਾਰੇ ਸਾਨੂੰ ਪੜ੍ਹਾਇਆ ਜਾਂਦਾ ਹੈ ਜੋ ਕਿ ਜ਼ਰੂਰੀ ਹੈ ਅਤੇ ਇਹੀ ਵਿਸ਼ਿਆਂ ਨਾਲ ਅੱਗੇ ਜਾ ਕੇ ਬੱਚਾ ਆਪਣੀ ਮਰਜ਼ੀ ਦਾ ਕੁਛ ਚੂਸ ਕਰਕੇ ਆਪਣੀ ਮਰਜ਼ੀ ਦਾ ਕੁਛ ਫੀਲਡ ਚੂਸ ਕਰ ਲੈਂਦਾ ਹੈ